ਅਸੀਂ ਆਪਣੇ ਘਰ ਨੂੰ ਧੋਣ ਲਈ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਜਿਵੇਂ ਕਿ ਲਾਈਜੋਲ ਡੈਟੋਲ ਪਾ ਕੇ ਧੋਂਦੇ ਹਾਂ ਅਸੀਂ ਆਪਣੇ ਘਰ ਨੂੰ ਧੋਣ ਲਈ ਕਈ ਵਾਰ ਸਰਫ਼ ਵੀ ਵਰਤਦੇ ਹਾਂ ਪਰ ਕਿਉਂਕਿ ਇਹ ਸਾਰੇ ਕੈਮੀਕਲ ਨਾਲ ਹੀ ਬਣਦੇ ਹਨ ਜਿਸ ਕਰਕੇ ਇਹ ਸਿਹਤ ਲਈ ਹਾਨੀਕਾਰਕ ਹੀ ਹਨ ਪਰ ਅਸੀਂ ਪਿਛਲੇ ਸਮੇਂ ਵਿੱਚ ਵੀਹ ਕੁ ਸਾਲ ਪਹਿਲਾਂ ਹੀ ਅਸੀਂ ਆਪਣੇ ਘਰਾਂ ਵਿੱਚ ਗੋਬਰ ਵਰਤ ਕੇ ਘਰ ਨੂੰ ਸਾਫ਼ ਕਰਦੇ ਸੀ ਜੋ ਕਿ ਬਹੁਤ ਲਾਭਦਾਇਕ ਹੁੰਦਾ ਸੀ ਅੱਜ ਅਸੀਂ ਆਧੁਨਿਕਤਾ ਦੇ ਚੱਕਰ ਵਿੱਚ ਆਪਣੇ ਘਰ ਪੱਕੇ ਕਰ ਲਏ ਹਨ ਜਿਨ੍ਹਾਂ ਦੀ ਸਫ਼ਾਈ ਬਸ ਇੱਕ ਕੱਪੜੇ ਨੂੰ ਸਾਰੇ ਘਰ ਵਿੱਚ ਮਾਰ ਕੇ ਸਾਫ਼ ਕਰ ਲੈਂਦੇ ਹਾਂ ਜਿਸ ਵਿੱਚ ਕੋਈ ਵੀ ਸਿਆਣਪਤਾ ਨਹੀਂ ਅਸੀਂ ਇਸ ਲਈ ਹੋਰ ਹੋਰ ਤਰੀਕੇ ਵੀ ਵਰਤ ਸਕਦੇ ਹਾਂ ਭਾਵੇਂ ਅਸੀਂ ਸੋਚੀਏ ਕਿ ਡਟੋੋਲ ਪਾ ਕੇ ਘਰ ਸਾਫ਼ ਹੋ ਹੋ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਹਿਤ ਦਵਾਉਂਦਾ ਦਵਾਉਂਦੀ ਹੈ ਪਰ ਇਹਨਾਂ ਵਿੱਚ ਕੈਮੀਕਲ ਤਾਂ ਹੈ ਹੀ ਹਨ ਜੋ ਕੀਟਨਾਸ਼ਕ ਹਨ ਪਰ ਸਿਹਤ ਲਈ ਵੀ ਕਿਸੇ ਹੱਦ ਤੱਕ ਨੁਕਸਾਨਦਾਇਕ ਹਨ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਹੁਣ ਸਾਨੂੰ ਫਿਰ ਤੋਂ ਕੱਚੇ ਘਰਾਂ ਵਿੱਚ ਆ ਜਾਣਾ ਚਾਹੀਦਾ ਹੈ ਪਰ ਸਾਨੂੰ ਇਹਨਾਂ ਕੈਮੀਕਲਾਂ ਵਰਗੀ ਚੀ ਵਰਗੀਆਂ ਚੀਜ਼ਾਂ ਤੋਂ ਤੋਬਾ ਕਰਨੀ ਚਾਹੀਦੀ ਹੈ ਘਰ ਧੋਣ ਲਈ ਦੇਸੀ ਨੁਸਖੇ ਵਰਤ ਕੇ ਵਰਤ ਕੇ ਚਾਹੀਦੇ ਹਨ ਅਸੀਂ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਘਰ ਨੂੰ ਸਾਫ਼ ਕਰ ਸਕਦੇ ਹਾਂ ਜੋ ਕਿ ਆਯੂਰਵੈਦਿਕ ਤਾਂ ਹੈ ਹੀ ਸਾਡੇ ਘਰ ਨੂੰ ਬਿਮਾਰੀਆਂ ਤੋਂ ਵੀ ਰਹਿਤ ਦਵਾਂਦੀ ਦਿੰਦਾ ਹੈ ਹੋਰ ਵੀ ਇਸ ਤਰ੍ਹਾਂ ਦੇ ਨੁਸਖੇ ਕੰਮ ਵਿੱਚ ਲਿਆਏ ਜਾ ਸਕਦੇ ਹਨ